ਉੱਨੀ ਸੌ ਪੰਜਾਹ ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਭਾਰਤੀ ਅਰਥਚਾਰੇ ਦਾ ਕਾਫੀ ਵਿਕਾਸ ਹੋਇਆ ਹੈ ਇਸ ਵਾਧੇ ਵਿੱਚ ਬਹੁਤ ਸਾਰੀ ਯੋਗਾਂ ਨੇ ਯੋਗਦਾਨ ਪਾਇਆ ਹੈ ਜਿਨਾਂ ਵਿੱਚ ਕੁਝ ਉਦਯੋਗ ਜਿਵੇਂ ਕਿ ਨਿਰਮਾਣ ਉਦਯੋਗ ਜਿਸ ਦੀ ਸਭ ਤੋਂ ਵੱਡੀ ਉਦਾਹਰਨ ਟਾਟਾ ਸਟੀਲ ਇੰਡਸਟਰੀ ਸਿਹਤ ਸੇਵਾਵਾਂ ਕੇਂਦਰਾਂ ਦਾ ਵਿਕਾਸ ਸਿੱਖਿਆ ਦੇ ਖੇਤਰ ਵਿੱਚ ਹੋਇਆ ਵਾਧਾ ਅਤੇ ਯਾਤਾਯਾਤ ਦੇ ਖੇਤਰਾਂ ਵਿੱਚ ਹੋਇਆ ਵਿਕਾਸ ਉਹਨਾਂ ਉਦਯੋਗਾਂ ਦੀ ਮੁੱਖ ਉਦਾਹਰਨ ਹੈ ਜਿਹਨਾਂ ਨੇ ਭਾਰਤੀ ਅਰਥਚਾਰੇ ਨੂੰ ਬਹੁਤ ਵਿਕਸਿਤ ਕੀਤਾ ਹੈ ਇਹਨਾਂ ਦੇ ਨਾਲ ਨਾਲ ਇੰਟਰਨੈਟ ਅਤੇ ਡਿਜੀਟਲ ਬੈਂਕਿੰਗ ਵਿਵਸਥਾ ਨੇ ਵੀ ਭਾਰਤੀ ਅਰਥ ਵਿਵਸਥਾ ਨੂੰ ਕਾਫ਼ੀ ਵਿਕਸਿਤ ਕੀਤਾ ਹੈ ਡਿਜੀਟਲ ਭੁਗਤਾਨ ਕਰਨ ਨਾਲ ਧੋਖਾਧੜੀ ਅਤੇ ਡਾਟਾ ਦੇ ਨਸ਼ਟ ਹੋ ਜਾਣ ਦਾ ਡਰ ਨਹੀਂ ਰਹਿੰਦਾ ਬੈਂਕਾਂ ਦੀ ਵੀ ਭਾਰਤੀ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਕਾਫ਼ੀ ਵੱਡਾ ਯੋਗਦਾਨ ਹੈ ਜਿਸ ਦੀ ਸਭ ਤੋਂ ਵੱਡੀ ਉਦਾਹਰਣ ਭਾਰਤ ਦੀ ਰਿਜ਼ਰਵ ਬੈਂਕ ਔਫ ਇੰਡੀਆ ਹੈ